ਸਾਡੇ ਪਿੰਡਾਂ ਦੇ ਵਿੱਚ ਕਬਜ਼ ਦੇ ਇਲਾਜ ਲਈ ਵੱਖ ਵੱਖ ਘਰੇਲੂ ਨੁਸਖੇ ਹਨ ਆਯੁਰਵੇਦ ਅਨੁਸਾਰ ਵੀ ਕਬਜ਼ ਸਾਰੇ ਰੋਗਾਂ ਦੀ ਜੜ੍ਹ ਹੈ ਜੇਕਰ ਆਪਣਾ ਪੇਟ ਸਵੇਰੇ ਸਾਫ਼ ਨਹੀਂ ਹੁੰਦਾ ਤਾਂ ਇਸ ਦੇ ਵਿੱਚ ਫਸਿਆ ਅੰਤੜੀਆਂ ਦੇ ਵਿੱਚ ਫਸਿਆ ਮਲ ਮੂਤਰ ਸਾਨੂੰ ਅਨੇਕਾਂ ਬਿਮਾਰੀਆਂ ਨੂੰ ਪੈਦਾ ਕਰਦਾ ਹੈ ਕਬਜ਼ ਦੇ ਇਲਾਜ ਲਈ ਅਕਸਰ ਹੀ ਸਭ ਤੋਂ ਪ੍ਰਸਿੱਧ ਨੁਸਖਾ ਤ੍ਰਿਫਲਾ ਚੂਰਨ ਹੈ ਇਹ ਚੂਰਨ ਲੋਕ ਰਾਤ ਨੂੰ ਪੈਣ ਲੱਗੇ ਲੈਂਦੇ ਹਨ ਅਤੇ ਸਵੇਰੇ ਪੇਟ ਸਾਫ਼ ਦੇ ਵਿੱਚ ਇਹ ਬਹੁਤ ਸਹਾਈ ਹੁੰਦਾ ਹੈ ਪਰ ਇਸ ਤੋਂ ਇਲਾਵਾ ਹੋਰ ਨੁਸਖੇ ਵੀ ਪ੍ਰਸਿੱਧ ਹਨ ਜਿਵੇਂ ਸੌਂਫ ਦਾ ਪਾਣੀ ਅਤੇ ਕਈ ਲੋਕ ਕਬਜ਼ ਨੂੰ ਖਤਮ ਕਰਨ ਲਈ ਪਾਣੀ ਦੀ ਜ਼ਿਆਦਾ ਵਰਤੋਂ ਵੀ ਕਰਦੇ ਹਨ ਕਬਜ਼ ਨੂੰ ਰੋਕਣ ਲਈ ਸੇਂਦਾ ਨਮਕ ਸਨਾਏ ਸੌਂਠ ਅਤੇ ਛੋਟੀ ਹਰੜ ਦਾ ਪਾਊਡਰ ਵੀ ਲਾਭਕਾਰੀ ਮੰਨਿਆ ਜਾਂਦਾ ਹੈ ਇਹ ਨੁਸਖਾ ਵੀ ਸਾਡੇ ਪਿੰਡਾਂ ਦੇ ਵਿਚ ਆਮ ਵਰਤਿਆ ਜਾਂਦਾ ਹੈ ਇਸ ਤੋਂ ਇਲਾਵਾ ਅਸੀਂ ਕਬਜ਼ ਨੂੰ ਰੋਕਣ ਲਈ ਪ੍ਰਾਣਾਯਾਮ ਯੁਗ ਯੋਗ ਦਾ ਇੱਕ ਹਿੱਸਾ ਹੈ ਉਸਦੀ ਮਦਦ ਵੀ ਕਰਦੇ ਹਾਂ ਕਬਜ਼ ਨੂੰ ਦੂਰ ਕਰਨ ਲਈ ਕਪਾਲਭਾਤੀ ਆਸਣ ਸਾਡੇ ਪਿੰਡਾਂ ਦੇ ਵਿੱਚ ਬਹੁਤ ਮਸ਼ਹੂਰ ਹੈ ਕਪਾਲਭਾਤੀ ਅ ਆਸਣ ਕਰਨ ਨਾਲ ਅੰਤੜੀਆਂ ਦੀ ਸਫਾਈ ਹੋ ਜਾਂਦੀ ਹੈ ਅਤੇ ਸਵੇਰੇ ਪੇਟ ਬਹੁਤ ਚੰਗੀ ਤਰ੍ਹਾਂ ਸਾਫ਼ ਹੁੰਦਾ ਹੈ ਅਤੇ ਸਾਡੇ ਜਿਹੜੇ ਦੁਸ਼ੈਲੇ ਤੱਤ ਹਨ ਉਹ ਸਰੀਰ ਦੇ ਵਿੱਚੋਂ ਬਾਹਰ ਨਿਕਲ ਜਾਂਦੇ ਹਨ ਇਸ ਤੋਂ ਇਲਾਵਾ ਅਕਸਰ ਹੀ ਲੋਕਾਂ ਨੂੰ ਅਸੀਂ ਆਪਣੇ ਪਿੰਡਾਂ ਵਿੱਚ ਕਹਿੰਦੇ ਸੁਣਿਆ ਹੈ ਕਿ ਆਪਣਾ ਖਾਣ ਪਾਣ ਵਧੀਆ ਰੱਖੋ ਗਰਮ ਪਾਣੀ ਵੀ ਅਸੀਂ ਸਵੇਰੇ ਉੱਠ ਕੇ ਪੀ ਕੇ ਕਬਜ਼ ਨੂੰ ਰੋਕ ਸਕਦੇ ਹਾਂ ਅਤੇ ਇਸ ਭਿਆਨਕ ਬਿਮਾਰੀ ਤੋਂ ਛੁਟਕਾਰਾ ਪਾ ਸਕਦੇ ਹਾਂ